ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਜੀ ਜੀ

ਜੀ ਜੀ ਸਰ ਜੀ ਧੰਨਵਾਦ ਜੀ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਕਾਲ ਕੀਤੀ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਤੋਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਖਾਣਾ ਪਸੰਦ ਕਰਦੇ ਹੈਗੇ ਜੀ ਅਤੇ ਤੁਸੀਂ ਬਜਟ ਕਿੰਨਾ ਕੁ ਸੋਚ ਰਹੇ ਹੋ ਕਰਕੇ ਤੁਸੀਂ ਕਿੰਨਾ ਕੁ ਅਤੇ ਸਰ ਤੁਸੀਂ ਕਿੰਨੇ ਕੁ ਮੈਂਬਰਸ ਹੋ ਤੁਸੀਂ ਮੈਂਬਰ ਦੇ ਥਰੂ ਜਾਣਾ ਚਾਹੁੰਦੇ ਹੋ ਅੱਛਾ ਤੁਸੀਂ ਫੈਮਲੀ ਦੇ ਲਈ ਰੇਸਟੋਰੰਟ ਦੇਖਣਾ ਚਾਹ ਰਹੇ ਹੋ

ਮਤਲਬ ਤੁਸੀਂ ਕਲੀਨ ਐਂਡ ਹਾਈਜੈਨਿਕ ਪਲੇਸ ਕਹਿ ਰਹੇ ਹੋ ਨਾ ਸਰ ਜੀ ਸਰ ਅਤੇ ਇੱਕ ਚੀਜ਼ ਹੋਰ ਸਰ ਤੁਸੀਂ ਮਤਲਬ ਕਿ ਇਸਦੇ ਵਿੱਚ ਵੈਜੀਟੇਰੀਅਨ ਪਸੰਦ ਕਰੋਗੇ ਨੋਨ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਸਰ ਜੀ ਸਰ ਜੀ ਸਰ ਮੈਂ ਤੁਹਾਨੂੰ ਇਸਦੇ ਵਿੱਚ ਸਭ ਤੋਂ ਪਹਿਲਾਂ ਰਿਕਮੈਂਡ ਕਰੂੰਗਾ ਸਰ ਈਟ ਐਂਡ ਫੂਡਸ ਵਾਰ ਸਰ ਇਹ ਆਪਣਾ ਅੱਛਾ ਜੀ ਮਤਲਬ ਕਿ ਅੱਛਾ ਮਤਲਬ ਅੱਛਾ ਅੱਛਾ ਨਹੀਂ ਸਰ ਫਿਰ ਮੈਂ ਇਸ ਦੇ ਵਿੱਚ ਸਰ ਸਾਡੀ ਸਭ ਤੋਂ ਪਹਿਲੀ ਰਿਕਮੈਂਡੇਸ਼ਨ ਹੋਊਗੀ ਸਰ ਸਾਗਰ ਰਤਨ ਕਪੂਰਥਲਾ ਰੈਸਟੋਰੈਂਟ ਇਸਦੇ ਵਿੱਚ ਸਰ ਤੁਹਾਨੂੰ ਦੋ ਸੌ ਤੋਂ ਚਾਰ ਸੌ ਪਰ ਪਰਸਨ ਜਿਹੜਾ ਕਿ ਖਾਣਾ ਅਵੇਲੇਬਲ ਹੋ ਜੂਗਾ ਇਹ ਸਰ ਇੱਥੇ ਦਾ ਅਤੇ ਹਾਈਜੀਨ ਅਤੇ ਟੋਪ ਕਲਾਸ ਹੈ ਸਰ ਅਤੇ ਇਸ ਤੋਂ ਇਲਾਵਾ ਸਰ ਮੈਂ ਫਿਰ ਤੁਹਾਨੂੰ ਰਿਕਮੈਂਡ ਕਰੂੰਗਾ ਜੇ ਤੁਸੀਂ ਸਰ ਸਿੰਪਲ ਰੋਟੀ ਖਾਣੀ ਹੈ ਸਰ ਤਾਂ ਤੁਸੀਂ ਚਾਹੁੰਦੇ ਹੋ ਕਿ ਆਪਾਂ ਢਾਬੇ ਢਾਬੇ ਟਾਈਪ ਢਾਬੇ ਵਾਂਗ ਆਪਾਂ ਜਾ ਕੇ ਦੇਖੀਏ ਕਿਸੇ ਜਗ੍ਹਾ 'ਤੇ ਉਸ ਦੇ ਵਿੱਚ ਸਰ ਸਾਡਾ ਹੈਗਾ ਚਿੜੀ ਦਾ ਢਾਬਾ ਚਿੜੀ ਦਾ ਢਾਬਾ ਜੀ ਸਰ ਜੀ ਇਸਦੇ ਵਿੱਚ ਸਰ ਤੁਹਾਨੂੰ ਮਤਲਬ ਕਿ ਅਫੋਰਡੇਬਲ ਪ੍ਰਾਈਜ 'ਤੇ ਸਰ ਵਧੀਆ ਖਾਣਾ ਮਿਲ ਜੂਗਾ ਸਰ ਠੀਕ ਹੈ ਕਲੀਨਿੰਗ ਐਂਡ ਹਾਈਜੈਨਿਕ ਦਾ ਸਰ ਇਹ ਵੀ ਪੂਰਾ ਧਿਆਨ ਰੱਖਦੇ ਹੈ ਸਰ ਤਾਂ ਸਰ ਇਸ ਦੇ ਵਿੱਚ ਸਰ ਫਿਰ ਉਹੀ ਬਾਰ ਵਗੈਰਾ ਦਾ ਸਰ ਇਸ਼ੂ ਆ ਜਾਂਦਾ ਬਾਕੀ ਇਸ ਤਰ੍ਹਾਂ ਦਾ ਸਰ ਇਸ ਲੋਕੈਲਟੀ ਦੇ ਵਿੱਚ ਸਰ ਨਹੀਂ ਹੋਊਗਾ ਕਿਉਂਕਿ ਉਸਦੇ ਵਿੱਚ ਸਰ ਬਾਰ ਇਨਕਲੂਡ ਹੋਊਗਾ ਤੁਸੀਂ ਕਹਿ ਰਹੇ ਹੋ ਕਿ ਬਾਰ ਨਹੀਂ

ਤੁਸੀਂ ਸਰ ਇਹਨਾਂ ਦੇ ਵਿੱਚੋਂ ਕੋਈ ਵੀ ਵਧੀਆ ਸਲੈਕਟ ਕਰ ਸਕਦੇ ਹੋ ਓਕੇ ਸਰ ਥੈਂਕ ਯੂ ਫਾਰ ਕਾਲਿੰਗ